ਹਾਂਜੀ ਬਹੁਤ ਇੱਦਾਂ ਦੇ ਕਾਰੋਬਾਰ ਹੁੰਦੇ ਆ ਜਿਹਨਾਂ ਨੂੰ ਵਾਤਾਵਰਨ ਨੂੰ ਬੋ ਜਿਹਨਾਂ ਕਰਕੇ ਵਾਤਾਵਰਨ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਦਾ ਸਾਡੀ ਸਥਿਤੀ ਵਿੱਚ ਮੈਨੂੰ ਇੱਦਾਂ ਲੱਗਦਾ ਕਿ ਸਰਕਾਰ ਨੂੰ ਇਹਨਾਂ ਦੇ ਪ੍ਰਤੀ ਕਦਮ ਚੁੱਕਣੇ ਚਾਹੀਦੇ ਨੇ ਬਹੁਤ ਹੀ ਜ਼ਿਆਦਾ ਕਿਉਂਕਿ ਹਾਲ ਹੀ ਵਿੱਚ ਇੱਕ ਨਿਊਜ਼ ਪਿੱਛੇ ਜਿਹੇ ਆਈ ਸੀ ਜਿਹਨਾਂ ਦੇ ਜਿਹਦੇ ਵਿੱਚ ਸੀਗਾ ਕਿ ਜਿਵੇਂ ਹੋਜ਼ਰੀ ਦੀਆਂ ਹੋਜ਼ਰੀ ਦੀਆਂ ਮਿੱਲਾਂ ਨੇ ਤਾਜਪੁਰ ਰੋਡ ਵੱਲ ਅਤੇ ਉਹਨਾਂ ਉੱਥੇ ਜਿਹੜਾ ਗੰਦਾ ਨਾਲਾ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਹੋਇਆ ਉਹ ਨਾਲ੍ਹਾ ਠੀਕ ਆ ਬੁੱਢਾ ਨਾਲ੍ਹਾ ਜਦੋਂ ਕਿ ਅੱਗੇ ਜਾ ਕੇ ਜਦੋਂ ਦੇਖਦੇ ਤਾਂ ਪਾਣੀ ਬਹੁਤ ਸਾਫ ਆ ਇਹਨਾਂ ਦੁਕਾਨ ਸ਼ੋ ਹੋਜ਼ਰੀ ਕਰਕੇ ਇਹਨਾਂ ਦੇ ਜੇਰੇ ਜਿਹੜੇ ਖੇਤਰ ਚੱਲ ਰਹੇ ਨੇ ਉਹਨਾਂ ਕਰਕੇ ਵਾਤਾਵਰਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪਾਣੀ ਬਹੁਤ ਜ਼ਿਆਦਾ ਗੰਦਾ ਹੋ ਚੁੱਕਾ ਆ ਜੇ ਉਹ ਪਾਣੀ ਯੂਸ ਕਰਦੇ ਹਾਂ ਤਾਂ ਉਹ ਬਹੁਤ ਲੋਕਾਂ ਨੂੰ ਨੁਕਸਾਨ ਹੋਊਗਾ ਉਸ ਪਾਣੀ ਦਾ ਕਿਉਂਕਿ ਬੱਚੇ ਜੇ ਕੋਈ ਜਾਨਵਰ ਉਸ ਪਾਣੀ ਨੂੰ ਪੀਦਾਂ ਅਤੇ ਉਹ ਜ਼ਰੂਰ ਕੋਈ ਨਾ ਕੋਈ ਬਿਮਾਰੀ ਦਾ ਜ਼ਰੂਰ ਸ਼ਿਕਾਰ ਹੋਊਗਾ ਕਿਉਂਕਿ ਉਹ ਪਾਣੀ ਬਹੁਤ ਗੰਦਾ ਆ ਇਹੋ ਜਿਹੀ ਸਥਿਤੀ ਵਿੱਚ ਨਾ ਸਰਕਾਰ ਨੂੰ ਉਹ ਜਾਂ ਤਾਂ ਨਾਲ੍ਹਾ ਬੰਦ ਕਰਾਉਣ ਜਾਂ ਫਿਰ ਨਾਲ੍ਹੇ ਨੂੰ ਸਾਫ ਕਰਾਉਣ ਜਾਂ ਫਿਰ ਉੱਥੋਂ ਹੋਜ਼ਰੀ ਦੀਆਂ ਮਿੱਲਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਕਹਿਣ ਵੀ ਤੁਸੀਂ ਇਹ ਇਹ ਚੀਜ਼ ਨੂੰ ਨਹੀਂ ਖਰਾਬ ਕਰ ਸਕਦੇ ਕਿਉਂਕਿ ਇਹ ਨੇਚਰ ਹੈ ਇਹ ਕੁਦਰਤ ਆ ਇਹਨੂੰ ਨਹੀਂ ਆਪਾਂ ਖਰਾਬ ਕਰ ਸਕਦੇ ਆਪਾਂ ਆਪਣੀ ਆਪਣੀ ਪਾਣੀ ਪੀਣ ਵਾਲਾ ਜੇ ਖਰਾਬ ਕਰਾਂਗੇ ਤਾਂ ਆਪਾਂ ਨੂੰ ਫਿਰ ਪਾਣੀ ਦਾ ਕੋਈ ਸੋਰਸ ਨਹੀਂ ਹੈਗਾ